ਹੈਲੋ ਹਾਂਜੀ ਭਾ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਕਿਆ ਹਾਲ ਚਾਲ ਹੈ ਹਾਂਜੀ ਹਾਂਜੀ ਵਧੀਆ ਆਪਾਂ ਸਭ ਵਧੀਆ ਜੀ ਬੱਚੇ ਵੀ ਸਭ ਘੈਂਟ ਹੈ ਜੀ ਸਕੂਲ ਭਾ ਜੀ ਨਵਾਂ ਸ਼ਹਿਰ ਏਰੀਏ 'ਚ ਬਹੁਤ ਵਧੀਆ ਏ ਹੁਣ ਜਿੱਦਾਂ ਹੁਣ ਆਪਾਂ ਪਿੱਛੇ ਜੇ ਸਰਕਾਰ ਨੇ ਭਰਤੀ ਕੀਤੀ ਸੀਗੀ ਇੱਕ ਤਾਂ ਆਹ ਦੋ ਸਾਲ ਪਹਿਲਾਂ ਜਿਹੜੇ ਟੀਚਰਾਂ ਦੀ ਭਰਤੀ ਕੀਤੀ ਸੀਗੀ ਇਹਦੇ ਕਰਕੇ ਜਿਹੜੇ ਸਰਕਾਰੀ ਸਕੂਲਾਂ ਦੇ ਰਿਜਲਟ ਵੀ ਭਾ ਜੀ ਕਾਫ਼ੀ ਵਧੀਆ ਆਏ ਹੈਗੇ ਹੈ ਹਾਂਜੀ ਇਹ ਤੋਂ ਇਲਾਵਾ ਭਾ ਜੀ ਪ੍ਰਾਈਵੇਟ ਸਕੂਲ ਵੀ ਕਾਫ਼ੀ ਵਧੀਆ ਹੈਗਾ ਜਿੱਦਾਂ ਹੁਣ ਸ਼ਿਵਾਲਿਕ ਸਕੂਲ ਹੋ ਗਿਆ ਕਾਫ਼ੀ ਪੁਰਾਣਾ ਇੱਥੇ ਦਾ ਰੋਪ ਇੱਥੇ ਦਾ ਨਵਾਂ ਸ਼ਹਿਰ ਦਾ ਜੀ ਉਹ ਤਾਂ ਇਹ ਤੋਂ ਇਲਾਵਾ ਹੋ ਗਿਆ ਜਿੱਦਾਂ ਇੱਕ ਨੇਤਾ ਜੀ ਸਕੂਲ ਹੋ ਗਿਆ ਹੌਲੀ ਫੈਮਿਲੀ ਹੋ ਗਿਆ ਸੈਂਟ ਮੈਰੀ ਹੋ ਗਿਆ ਹਾਂਜੀ ਹਾਂਜੀ ਇਹ ਵੀ ਕਾਫ਼ੀ ਵਧੀਆ ਹੈਗੇ ਹੈ ਜੀ ਭਾ ਜੀ ਜਿੱਦਾਂ ਹੁਣ ਆਪਾਂ ਜੇ ਤਾਂ ਸਰਕਾਰੀ ਸਕੂਲ ਲਾਈਏ ਸਰਕਾਰੀ ਸਕੂਲਾਂ 'ਚ ਤਾਂ ਭਾ ਜੀ ਨਾ ਮਾਤਰ ਦੀ ਓ ਫ਼ੀਸ ਹੁੰਦੀ ਹੈਗੀ ਹੈ ਜਿਹੜੇ ਹੈਗੇ ਪ੍ਰਾਈਵੇਟ ਸਕੂਲ ਉਹਨਾਂ 'ਚ ਤਾਂ ਭਾ ਜੀ ਤੁਹਾਨੂੰ ਪਤਾ ਹੀ ਹੋਣਾ ਪ੍ਰਾਈਵੇਟ ਸਕੂਲ ਤਾਂ ਕਾਫ਼ੀ ਫ਼ੀਸ ਹੁੰਦੀ ਹੈਗੀ ਹੈ ਨਾ ਹਾਂਜੀ ਹਾਂਜੀ ਇਹ ਤੋਂ ਇਲਾਵਾ ਭਾ ਜੀ ਜਿਹੜੇ ਫ਼ੀਸ ਲੈਂਦਾ ਏ ਜਿੱਦਾਂ ਪ੍ਰਾਈਵੇਟ ਸਕੂਲ ਵਾਲੇ ਲੈਂਦੇ ਹੈਗੇ ਨਾ ਜਿਹੜੇ ਸਰਕਾਰੀ ਸਕੂਲ ਹੁੰਦੇ ਜਿਹੜੀ ਬੱਚਿਆਂ ਦੀ ਜਿਹੜੀ ਕੋ ਕਰਿਕੁਲਰ ਐਕਟੀਵੀਟਿਜ਼ ਹੁੰਦੀਆਂ ਹੀ ਅਤੇ ਇਲਾਵਾ ਜਿਹੜੀ ਗੇਮਿੰਗ ਵਗੈਰਾ ਅਤੇ ਇਹ ਘੱਟ ਧਿਆਨ ਦਿੰਦੇ ਹੈਗੇ ਹੈ ਇਹ ਸ਼ਿਵਾਲਿਕ ਸਕੂਲ ਭਾ ਜੀ ਵਧੀਆ ਬੈਸਟ ਹੈ ਗੇਮਿੰਗ ਗੁਮੀ ਗੇਮਿੰਗ ਵਗੈਰਾ ਭਾ ਜੀ ਵਧੀਆ ਏ ਇੱਥੇ ਜਿਹੜੇ ਸਟੂਡੇਂਟ ਹੈਗੇ ਉਹ ਨੈਸ਼ਨਲ ਲੈਵਲ ਦੇ ਪਾਰਟੀਸਪੇਟ ਕਰਦੇ ਹੈਗੇ ਜਿਹੜੀ ਗੇਮਾਂ ਵਗੈਰਾ ਨਹੀਂ ਹੁੰਦੀਆਂ ਹੈਗੀਆਂ ਉਹਨਾਂ 'ਚ ਵੀ ਉਹ ਕਰਦੇ ਹੈਗੇ ਹੈ ਹਿੱਸਾ ਲੈਂਦੇ ਹੈਗੇ ਹੈ ਉਹ ਨੈਸ਼ਨਲ ਲੈਵਲ 'ਤੇ ਆਹ ਪਿੱਛੇ ਜੇ ਦੋ ਖਿਡਾਰੀ ਗਏ ਹੋਏ ਸੀ ਇਹਨਾਂ ਦੇ ਉਹ 'ਚ ਐਥਲੀਟਿਕਸ 'ਚ ਹਾਂਜੀ ਹਾਂਜੀ ਕੋਈ ਗੱਲ ਨਹੀਂ ਭਾ ਜੀ ਠੀਕ ਹੈ ਜੀ ਵੈਲਕੱਮ ਜੀ ਓਕੇ ਵੈਲਕੱਮ ਭਾ ਜੀ ਵੈਲ